ਮੈਂ ਆਪਣੇ ਮੋਬਾਈਲ ਫੋਨ ਨੂੰ ਰੀਚਾਰਜ ਕਰਨਾ ਚਾਹੁੰਦੀ ਹਾਂ ਅਤੇ ਇਸ ਲਈ ਇਹ ਰੀਚਾਰਜ ਕਰਨ ਲਈ ਮੈਂ ਆਪਣੇ ਪਤਾ ਕਰਨ ਲਈ ਆਪਣੇ ਫੋਨ ਤੋਂ ਬਹੁਤ ਸਾਰੀਆਂ ਸਕੀਮਾਂ ਦਾ ਆਪਾਂ ਪਤਾ ਲਗਾ ਸਕਦੇ ਹਾਂ ਜਿਵੇਂ ਕਿ ਅਸੀਂ ਰੀਚਾਰਜ ਕਰਨ ਲਈ ਕਸਟਮਰ ਕੇਅਰ ਵਾਲਿਆਂ ਨੂੰ ਫੋਨ ਕਰਕੇ ਸਾਰੀਆਂ ਜੋ ਵੀ ਕੋਈ ਸਕੀਮਾਂ ਹੁੰਦੀਆਂ ਹਨ ਉਹਨਾਂ ਦਾ ਪਤਾ ਲਗਾ ਸਕਦੇ ਹਾਂ ਅਤੇ ਉਸ ਕਸਟਮਰ ਕੇਅਰ ਵਾਲੇ ਸਾਨੂੰ ਸਾਰੀ ਜਾਣਕਾਰੀ ਦੇ ਦਿੰਦੇ ਹਨ ਅਤੇ ਕੋਈ ਰੀ ਰੀਚਾਰਜ ਬਾਰੇ ਵੀ ਜਾਣਕਾਰੀ ਜੇ ਅਸੀਂ ਕਸਟਮਰ ਕੇਅਰ ਵਾਲਿਆਂ ਨੂੰ ਨਾ ਵੀ ਫੋਨ ਕਰੀਏ ਤਾਂ ਅਸੀਂ ਉਹਨਾਂ ਦੇ ਦਿੱਤੇ ਗਏ ਨੰਬਰਾਂ ਸਟਾਰ ਇੱਕ ਸੌ ਇੱਕੀ ਹੈਸ਼ 'ਤੇ ਅ ਲਗਾ ਕੇ ਸਾਰੀਆਂ ਸਕੀਮਾਂ ਦਾ ਪਤਾ ਕਰ ਸਕਦੇ ਹਾਂ ਜਿਸ 'ਤੇ ਸਾਨੂੰ ਪਤਾ ਲੱਗ ਜਾਂਦਾ ਹੈ ਕਿ ਸਾਡੇ ਫੋਨ 'ਤੇ ਕਿਹੜੀ ਸਕੀਮ ਚੱਲ ਰਹੀ ਹੈ ਅਤੇ ਅਸੀਂ ਉਸ ਸਕੀਮ ਦਾ ਉਸ ਸਕੀਮ ਦੇ ਹਿਸਾਬ 'ਤੇ ਆਪਣੇ ਫੋਨ ਦਾ ਰੀਚਾਰਜ ਕਰ ਕਰਵਾ ਲੈਂਦੇ ਹਾਂ ਸਕੀਮਾਂ ਹੁਣ ਥੋੜ੍ਹੇ ਜਿਹੇ ਸ ਰੇਟ ਵੱਧ ਗਏ ਹਨ ਬਟ ਫਿਰ ਵੀ ਸਾਨੂੰ ਇਹ ਕਰਵਾਉਣਾ ਹੀ ਪੈਂਦਾ ਹੈ ਅਤੇ ਇਹ ਇਸ ਕਿਉਂਕਿ ਇਸ ਤੋਂ ਬਿਨਾਂ ਸਾਡੀ ਜ਼ਿੰਦਗੀ ਬਹੁਤ ਮੁਸ਼ਕਿਲ ਹੈ ਫੋਨ ਤੋਂ ਬਿਨਾਂ ਫੋਨ ਫੋਣ ਫੋਨ ਚਲਾਉਣਾ ਸਾਡੇ ਲਈ ਬਹੁਤ ਜ਼ਰੂਰੀ ਹੈ ਕਿਉਂਕਿ ਬਿਨਾਂ ਨੈਟ ਤੋਂ ਅਸੀਂ ਕੋਈ ਵੀ ਕੰਮ ਨਹੀਂ ਕਰ ਸਕਦੇ ਅਤੇ ਰੀਚਾਰਜ ਕਰਵਾਉਣ ਲੱਗਿਆ ਸਾਨੂੰ ਸਾਨੂੰ ਰੀ ਅ ਨੈੱਟ ਵੀ ਰੀਚਾਰਜ ਕਰਵਾਉਣਾ ਪੈਂਦਾ ਹੈ ਉਸ ਵਾਸਤੇ ਵੀ ਪੈਸੇ ਪਵਾਉਣੇ ਪੈਂਦੇ ਹਨ ਜੋ ਕਿ ਬਹੁਤ ਜ਼ਰੂਰੀ ਹੋ ਗਿਆ ਹੈ ਅਤੇ ਇਸੇ ਤਰ੍ਹਾਂ ਹੀ ਫੋਨ 'ਤੇ ਸਾ ਸਾਨੂੰ ਸਾਰਾ ਘਰ ਬੈਠੇ ਹੀ ਪਤਾ ਲੱਗ ਜਾਂਦਾ ਹੈ ਕ ਅਸੀਂ ਕੋਈ ਗਾਣਾ ਲਵਾਉਣਾ ਹੋਵੇ ਉਹ ਵੀ ਲਗਵਾ ਸਕਦੇ ਹਾਂ ਅਤੇ ਆਪਣਾ ਰੀਚਾਰਜ ਕਰਵਾ ਸਕਦੇ ਹਾਂ ਅਤੇ ਸਾਨੂੰ ਇਹ ਵੀ ਸਾਨੂੰ ਪਤਾ ਲੱਗ ਜਾਂਦਾ ਹੈ ਕਿ ਕਿੰਨੀ ਤਰੀਕ ਨੂੰ ਸਾਡੇ ਪੈਸੇ ਖ਼ਤਮ ਹੋਣ ਵਾਲੇ ਹਨ ਅਤੇ ਅਸੀਂ ਉਸ ਤਰੀਕ ਤੋਂ ਪਹਿਲਾਂ ਵੀ ਪੈਸੇ ਇੱਕ ਅੱਧਾ ਦਿਨ ਪਹਿਲਾਂ ਵੀ ਪਵਾ ਸਕਦੇ ਹਾਂ ਜੇ ਜ਼ਰੂਰੀ ਹੋਵੇ ਤਾਂ